ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਸੁਰਜੀਤ ਸਿੰਘ ਗੱਲ ਕਰ ਰਿਹਾ ਜੀ ਸ਼ਿਵ ਟ੍ਰੈਵਲਰ ਤੋਂ ਗੱਲ ਕਰ ਰਹੇ ਹੋ ਜੀ ਸਰ ਐਕਚੁਲੀ ਮੈਂ ਕਿਆ ਉਹ ਨਾ ਟ੍ਰੈਵਲਰ ਬੁੱਕ ਕੀਤੀ ਸੀ ਇੱਕ ਮੈਂ ਆਪ ਆਪਣਾ ਜਿਹੜਾ ਕੈਸ਼ ਸੀਗਾ ਔਨਲਾਈਨ ਪੇ ਕੀਤਾ ਸੀਗਾ ਤੁਹਾਨੂੰ ਅਤੇ ਵਿਦ ਫੈਮਲੀ ਤੁਹਾਨੂੰ ਦੱਸਿਆ ਸੀ ਕਿ ਮੈਂ ਕ ਅਸੀਂ ਇਹ ਫੈਮਲੀ ਲੈ ਕੇ ਮੈਂ ਘੁੰਮਣ ਕ ਘੁੰਮਣ ਜਾ ਰਹੇ ਹਾਂ ਅਸੀਂ ਸਰ ਉਹ ਨਾ ਤਾਂ ਤੁਹ ਮੈਨੂੰ ਨਾ ਤਿੰਨ ਘੰਟੇ ਟੋਟਲ ਤੁਹਾਡੀ ਕੈਬ ਦਾ ਵੇਟ ਕੀਤਾ ਜੀ ਤਿੰਨ ਘੰਟੇ ਤੋਂ ਤੁਹਾਡੀ ਕੈਬ ਨਹੀਂ ਆਈ ਹੈਗੀ ਇਸ ਕਰਕੇ ਮੈਂ ਹੋਰ ਕੈਬ ਬੁੱਕ ਕਰ ਲਈ ਹੈ ਜੀ ਅਤੇ ਬਾਕੀ ਸਰ ਇੱਕ ਰਿਕੁਐਸਟ ਹੈਗੀ ਜਿੰਨਾਂ ਜਲਦੀ ਤੋਂ ਜਲਦੀ ਹੋ ਸਕਿਆ ਜਿਹੜੀ ਪੇਮੈਂਟ ਮੈਂ ਤੁਹਾਨੂੰ ਪੇ ਕੀਤੀ ਸੀਗੀ ਉਹ ਤਾਂ ਉਹਨੂੰ ਵਾਪਿਸ ਕਰ ਕਰ ਦੇ ਕਰ ਦਿਓ ਜੀ ਠੀਕ ਹੈ ਸਰ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਸਰ ਧੰਨਵਾਦ ਜੀ